ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰੀਤਮ ਸਿੰਘ ਬੋਲ ਰਹੇ ਓਂ ਜੀ ਮੈਂ ਸਿਮਰਨ ਗੱਲ ਕਰ ਰਹੀ ਹਾਂ ਮੈਂ ਤੁਹਾਡੀ ਕੈਬ ਬੁੱਕ ਕਰਨੀ ਸੀ ਮੇਰੇ ਮਾਤਾ ਜੀ ਚੰਡੀਗੜ੍ਹ ਸੈਕਟਰ ਤਰਤਾਲੀ ਵਿੱਚ ਰਹਿੰਦੇ ਹਨ ਉਹਨਾਂ ਨੂੰ ਚੰਡੀਗੜ੍ਹ ਤੋਂ ਵਾਪਿਸ ਆਪਣੇ ਪਿੰਡ ਲੈ ਕੇ ਆਉਣਾ ਜੀ ਜੋ ਕਿ ਚੰਡੀਗੜ੍ਹ ਤੋਂ ਪੰਜਾਹ ਕਿਲੋਮੀਟਰ ਦੂਰ ਸਥਿਤ ਹੈ ਕਿ ਤੁਸੀਂ ਇਹ ਕੰਮ ਕਰ ਦੋਂਗੇ ਅਤੇ ਦੇਖੋ ਜੀ ਤੁਸੀਂ ਚੰਡੀਗੜ੍ਹ ਤੋਂ ਚੱਲ ਕੇ ਖਰੜ ਤੋਂ ਹੁੰਦੇ ਹੋਏ ਕੁਰਾਲੀ ਬਾਈਪਾਸ ਤੋਂ ਲੰਘਦੇ ਹੋਏ ਸਾਡੇ ਪਿੰਡ ਭਾਗੋਵਾਲ ਪਹੁੰਚਣਾ ਹੈ ਕੱਲ੍ਹ ਸਵੇਰੇ ਤੁਸੀਂ ਛੇ ਵਜੇ ਮੇਰੇ ਮਾਤਾ ਜੀ ਨੂੰ ਮੇਰੇ ਦੱਸੇ ਪਤੇ ਉੱਤੇ ਲੈ ਕੇ ਆਉਣਾ ਅਗਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਮੈਂ ਉਹਨਾਂ ਦਾ ਮੋਬਾਈਲ ਨੰਬਰ ਤੁਹਾਡੇ ਵੱਟਸਐਪ ਉੱਤੇ ਭੇਜ ਦਿੰਦੀ ਹਾਂ ਅਤੇ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਆਪਣਾ ਚਾਰਜ ਵੀ ਦੱਸੋ ਤੁਸੀਂ ਕਿੰਨਾ ਕਿਰਾਇਆ ਲਵੋਂਗੇ ਠੀਕ ਹੈ ਜੀ ਅਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਕੋਲ ਪਹੁੰਚ ਕੇ ਉਹਨਾਂ ਨਾਲ ਤੁਸੀਂ ਗੱਲ ਕਰਕੇ ਮੇਰੀ ਗੱਲ ਉਹਨਾਂ ਦੇ ਨਾਲ ਤੁਸੀਂ ਜ਼ਰੂਰ ਇਸੇ ਨੰਬਰ 'ਤੇ ਕਰਵਾ ਦੇਣੀ